ਜੋ ਸ਼ਰਟ ਅਸੀਂ ਆਰਡਰ ਕੀਤੀ ਸੀ ਵਾਕੇ ਹੀ ਉਸ ਦਾ ਕੱਪੜਾ ਜੋ ਦੱਸਿਆ ਸੀ ਉਨਾਂ ਹੀ ਵਧੀਆ ਨਿਕਲਿਆ ਔਰ ਉਸ ਦਾ ਜੋ ਨਾਪ ਹੈ ਸਾਈਜ਼ ਹੈ ਉਹ ਮੈਨੂੰ ਬਿਲਕੁਲ ਫਿੱਟ ਆਇਆ ਔਰ ਮੈਂ ਬਹੁਤ ਖੁਸ਼ ਹੋਇਆ ਉਹਨੂੰ ਪਾ ਕੇ ਬਲਕਿ ਮੇਰੇ ਦੋਸਤਾਂ ਨੇ ਵੀ ਉਸ ਦੀ ਬਹੁਤ ਤਾਰੀਫ ਕੀਤੀ ਕਿ ਇਹ ਸ਼ਰਟ ਕਿੱਥੋਂ ਤੋਂ ਮੰਗਵਾਈ ਹੈ